ਪੰਜਾਬ ਵਿੱਚ ਅਨੇਕਾਂ ਤਿਉਹਾਰ ਮਨਾਏ ਜਾਂਦੇ ਹਨ ਜਿਵੇਂ ਦੁਸ਼ਹਿਰਾ ਦੀਵਾਲੀ ਅਤੇ ਵਿਸਾਖੀ ਇਹ ਪੰਜਾਬ ਦੇ ਪ੍ਰਮੁੱਖ ਤਿਉਹਾਰ ਮੰਨੇ ਜਾਂਦੇ ਹਨ ਇਹਨਾਂ ਤਿਉਹਾਰਾਂ ਵਿੱਚ ਪੰਜਾਬ ਵਿੱਚ ਬਹੁਤ ਜ਼ਿਆਦਾ ਰੌਣਕ ਅਤੇ ਖੁਸ਼ੀ ਦਾ ਮਾਹੌਲ ਹੁੰਦਾ ਹੈ ਇਹਨਾਂ ਤਿਉਹਾਰਾਂ ਨੂੰ ਲੋਕ ਰਲ ਮਿਲ ਕੇ ਮ ਮਨਾਉਂਦੇ ਹਨ ਦੀਵਾਲੀ ਨੂੰ ਲੋਕ ਆਪਣੇ ਰਿਸ਼ਤੇਦਾਰਾਂ ਵਿੱਚ ਗਿਫ਼ਟ ਵੰਡਦੇ ਹਨ ਅਤੇ ਬਹੁਤ ਖੁਸ਼ੀਆਂ ਵੰਡਦੇ ਹਨ ਦੁਸ਼ਹਿਰੇ ਨੂੰ ਦੁਸ਼ਹਿਰਾ ਗਰਾਊਂਡ ਵਿੱਚ ਬਹੁਤ ਰੌਣਕ ਹੁੰਦੀ ਹੈ ਜਿਸ ਵਿੱਚ ਰਾਵਣ ਦਾ ਪੁਤਲਾ ਸਾੜਿਆ ਜਾਂਦਾ ਹੈ ਅਤੇ ਵਿਸਾਖੀ ਵਿਸਾਖੀ ਦੌਰਾਨ ਜਿਹੜੇ ਵੀ ਆਪਣੇ ਕਿਸਾਨ ਭਾਈ ਹੁੰਦੇ ਹਨ ਉਹ ਆਪਣੀ ਫਸਲਾਂ ਨੂੰ ਕਟਵਾਉਂਦੇ ਹਨ ਅਤੇ ਫ਼ਰੀ ਕੰਮ ਤੋਂ ਫ਼ਰੀ ਹੋ ਜਾਂਦੇ ਹਨ ਉਹਨਾਂ ਵਿੱਚ ਬਹੁਤ ਖੁਸ਼ੀ ਦਾ ਮਾਹੌਲ ਹੁੰਦਾ ਹੈ ਅਤੇ ਵਿਸਾਖੀ ਦਾ ਮੇਲਾ ਲੱਗਦਾ ਹੈ ਜ